ਕੀ ਤੁਸੀਂ ਧੂੜੀਆਲ ਤੋਂ ਬੋਲਦੇ ਹੋ ਮੈਂ ਤੁਹਾਡੀ ਦੁਕਾਨ ਤੋਂ ਓਵਨ ਖਰੀਦਿਆ ਸੀਗਾ ਕੀ ਓਵਨ ਖਰੀਦਿਆ ਉਹਦੇ 'ਚ ਵਿੱਚੋਂ ਪਲੇਟ ਟੁੱਟੀ ਹੋਈ ਆ ਜਦੋਂ ਕਿ ਕੋਈ ਚੀਜ਼ ਰੱਖਦੇ ਹਾਂ ਤਾਂ ਉਹ ਚੀਜ਼ ਥੱਲੇ ਡਿੱਗ ਪੈਂਦੀ ਹੈ ਮੈਨੂੰ ਕੀ ਫ਼ਾਇਦਾ ਹੋਇਆ ਕਿ ਘਰ ਦੇ ਵੀ ਮੈਨੂੰ ਬੋਲੀ ਜਾਂਦੇ ਨੇ ਮੈਨੂੰ ਕੀ ਫ਼ਾਇਦਾ ਹੋਇਆ ਹੈ ਅਤੇ ਬਾਕੀ ਮੈਂ ਤਾਂ ਬਹੁਤ ਸੁਣਿਆ ਸੀ ਉੱਥੋਂ ਬਹੁਤ ਚੰਗੀਆਂ ਚੀਜ਼ਾਂ ਮਿਲਦੀਆਂ ਪਰ ਮੇਰਾ ਤਾਂ ਓਵਨ ਜਮਾਂ ਬੇਕਾਰ ਅਤੇ ਘਟੀਆ ਨਿਕਲਿਆ ਹੈਗਾ ਕਿਸੇ ਕੰਮ ਦਾ ਨਹੀਂ ਹੈਗਾ ਜਮਾਂ ਬੇਕਾਰ ਹੈਗਾ ਮੈਨੂੰ ਕੋਈ ਫ਼ਾਇਦਾ ਨਹੀਂ ਮੈਨੂੰ ਘਰ ਦੇ ਵੀ ਬੋਲਦੇ ਹੈ ਕਿ ਤੂੰ ਕਿੱਥੋਂ ਦੀ ਮੈਂ ਤਾਂ ਤੁਹਾਡੀ ਤੋਂ ਸੁਣ ਕੇ ਆਈ ਸੀ ਵਧੀਆ ਹੈ ਵਧੀਆ ਇਸ ਕਰਕੇ ਮੈਂ ਤੁਹਾਡੀ ਦੁਕਾਨ 'ਤੇ ਆਈ ਸੀਗੀ 'ਤੇ ਮੇਰਾ ਉਹ ਹੁਣ ਕਿਸੇ ਕੰਮ ਦਾ ਨਹੀਂ ਜਮਾਂ ਬੇਕਾਰ ਨਿਕਲਿਆ ਹੈਗਾ ਅਤੇ ਹੋਰ ਇਸ ਕਾਰਣ ਮੈਂ ਨਾ ਬਹੁਤ ਪਰੇਸ਼ਾਨ ਹਾਂ